ਮੈਨੂੰ ਕਿਉਂਕਿ ਯੋਗਾ ਦਾ ਸ਼ੌਕ ਬਹੁਤ ਹੈ ਲੇਕਿਨ ਪਿਛਲੇ ਟਾਈਮ 'ਚ ਮੇਰੇ ਨਾਲ ਇੱਕ ਇਸ ਤਰਾਂ ਦਾ ਐਕਸਪੀਰੀਅੰਸ ਫੇਸ ਹੋਇਆ ਅਤੇ ਮੇਰੀ ਇਲੈਕਸ਼ਨ ਡਿਊਟੀ ਸੀ ਔਰ ਮੈਂ ਇੱਕ ਪਿੰਡ ਦੇ ਨੇੜੇ ਗਿਆ ਸੀ ਜਿੱਥੇ ਕਿ ਜਿਹੜਾ ਇਹ ਸਾਨੂੰ ਸੈਂਟਰ ਮਿਲਿਆ ਗਿਆ ਸੀ ਜਿੱਥੇ ਸਟੇਸ਼ਨ ਸੀ ਸਾਡਾ ਉੱਥੇ ਵੀ ਯੋਗਾ ਵਾਸਤੇ ਕੋਈ ਮਾਹੌਲ ਠੀਕ ਨਹੀਂ ਸੀ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਪਾਰਟੀਆਂ ਦੀ ਖੱਪ ਸ਼ੋਰ ਸੀ ਜਾਂ ਸਾਡੇ ਹੋਰ ਸਟਾਫ ਮੈਂਬਰ ਜਿਸ ਤਰ੍ਹਾਂ ਆਪਣੀ ਆਪਣੀ ਜਗਾ ਲੈ ਕੇ ਬੈਠੇ ਸੀਗੇ ਅਤੇ ਜਦੋਂ ਮੈਂ ਸਵੇਰੇ ਉੱਠਿਆ ਅਤੇ ਮੈਨੂੰ ਇਹ ਇਹ ਮੁਸ਼ਕਿਲ ਦਰਪੇਸ਼ ਆਈ ਕਿ ਕਿ ਮੈਂ ਹੁਣ ਇੱਥੇ ਯੋਗਾ ਕਿਸ ਤਰ੍ਹਾਂ ਫੈਸਿਲਿਟੀ ਨਾਲ ਕਰ ਸਕਦਾ ਤਾਂ ਵੀ ਫਿਰ ਕਿਉਂਕਿ ਮੈਂ ਇਸ ਦੇ ਵਗੈਰ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਮਹਿਸੂਸ ਕਰਦਾ ਮੇਰੇ ਦਿਨ ਦੀ ਸ਼ੁਰੂਆਤ ਨਹੀਂ ਹੋ ਪਾਉਂਦੀ ਅਤੇ ਮੈਂ ਇੱਕ ਸਾਈਡ ਦੇ ਉੱਤੇ ਜਾ ਕੇ ਗੇਟ ਦੀ ਸਾਈਡ ਦੇ ਉੱਤੇ ਆਪਣੇ ਵਾਸਤੇ ਇੱਕ ਜਗਾ ਬਣਾਈ ਅਤੇ ਇੱਕ ਛੋਟੀ ਚਾਦਰ ਵਿਛਾ ਕੇ ਅਤੇ ਉੱਥੇ ਮੈਂ ਆਪਣੇ ਜਿਸ ਤਰ੍ਹਾਂ ਭੁਜੰਗ ਆਸਨ ਤਾੜ ਆਸਨ ਧਨੁਰ ਆਸਨ ਜਾਂ ਕੁਛ ਆਸਣ ਜਿਹੜੇ ਮੈਂ ਕਰਦਾ ਸੀ ਰੁਟੀਨ ਵਿੱਚ ਉਹਨਾਂ ਨੂੰ ਕਰਨ ਜਿੱਥੋਂ ਤੱਕ ਉਹ ਪੋਸੀਬਲ ਹੋਇਆ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਅਨ ਅ ਸੇ ਕੰਮਫਰਟੇਬਲ ਮਾਹੌਲ ਵਿੱਚ ਅ ਆਪਣੀ ਸਿਰਫ਼ ਇੱਕ ਸ਼ੌਕ ਆਦਤ ਜਾਂ ਮੇਰੀ ਇੰਨੀ ਜ਼ਰੂਰਤ ਜਿਹੜੀ ਮੇਰੀ ਬਣ ਗਈ ਸੀ ਉਹਦੇ ਕਾਰਨ ਮੈਨੂੰ ਕਰਨ ਵਿੱਚ ਕਾਮਯਾਬ ਹੋ ਸਕਿਆ ਇਹ ਮਤਲਵ ਇਹ ਇਹੋ ਜਿਹਾ ਮਾਹੌਲ ਮੈਨੂੰ ਪਹਿਲੋ ਕਦੀ ਪੇਸ਼ ਨਹੀਂ ਹੋਇਆ ਅ ਲੇਕਿਨ ਮੈਨੂੰ ਲੱਗਾ ਕਿ ਅ ਭਾਵੇਂ ਮੈਨੂੰ ਮੁਸ਼ਕਿਲ ਆਈ ਲੇਕਿਨ ਮੈਂ ਆਪਣਾ ਮੇਰਾ ਉਹ ਐਕਸਪੀਰੀਅੰਸ ਸੀ ਕਿ ਹਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ ਅਤੇ ਮੈਨੂੰ ਕਦੀ ਇਸ ਮੁਸ਼ਕਿਲ ਆਵੇ ਤਾਂ ਮੈਂ ਮੈਂ ਇਹਦੇ ਕਰਨ 'ਚ ਕਾਮਯਾਬ ਹੋ ਸਕਦਾ ਹਾਂ